ਛੱਬੀ ਫਰਵਰੀ ਉੱਨੀ ਸੌ ਨੱਬੇ ਪੰਜ ਫਰਵਰੀ ਦੋ ਹਜ਼ਾਰ ਸਤਾਰ੍ਹਾਂ ਨੌ ਜਨਵਰੀ ਉੱਨੀ ਸੌ ਬਾਨਵੇਂ ਇਕੱਤੀ ਅਕਤੂਬਰ ਦੋ ਹਜ਼ਾਰ ਸਤਾਰ੍ਹਾਂ ਚੌਵੀ ਫਰਵਰੀ ਦੋ ਹਜ਼ਾਰ ਗਿਆਰ੍ਹਾਂ